ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੀ ਖ਼ਾਸ ਅਪੀਲ ਇਸ ਲਈ ਹੈ ਕਿਉਂਕਿ ਇਹ ਰੰਗਾਂ ਦੀ ਚਾਹੀਦੀ ਨੂੰ ਹਟਾ ਦਿੰਦੀ ਹੈ ਅਤੇ ਚਰਿੱਤਰ ਦੇ ਹੋਰ ਅੰਕਤਕਾਰੀ ਪਾਸਿਆਂ ਨੂੰ ਕਿਸੇ ਵੀ ਰੋਸ਼ਨੀ ਛਾਂ ਬਰਤਨ ਬਣਤਰ ਅਤੇ ਗਹਿਰਾਈ ਨੂੰ ਉਜਾਗਰ ਕਰਦੀ ਹੈ ਰੰਗ ਦੇ ਬਿਨ੍ਹਾਂ ਦਸਕਤ ਦਾ ਧਿਆਨ ਸਿੱਧਾ ਵਿਸ਼ੇਸ਼ਤਾਵਾਂ 'ਤੇ ਜਾਂਦਾ ਹੈ ਜਿਸ ਨਾਲ ਇਹ ਅਦਵਿਤ ਅਤੇ ਕਲਾ ਦਾ ਅਹਿਸਾਸ ਹੁੰਦਾ ਹੈ ਮੋਨੋਕ੍ਰੋਮ ਫੋਟੋਗ੍ਰਾਫੀ ਅਕਸਰ ਘਟਨਾ ਜਾਂ ਵਿਸ਼ੇਸ਼ ਦੀ ਮਾਹੌਲ ਰੂਪ ਵਿੱਚ ਜਜ਼ਬਾਤਾਂ ਨੂੰ ਜ਼ਿਆਦਾ ਗਹਿਰਾਈ ਨਾਲ ਦਰਸਾਉਂਦੀ ਹੈ ਕਿਉਂਕਿ ਰੰਗਾਂ ਦੀ ਅਨਹੋਣ ਹੋਣੀ ਨਾਲ ਇਹ ਸਾਰੇ ਤੱਥ ਵਧੀਕ ਮਜ਼ਬੂਤ ਹੋ ਜਾਂਦੇ ਹਨ ਇਸ ਤਰੀਕੇ ਦੇ ਨਾਲ ਬਲੈਕ ਐਂਡ ਵਾਈਟ ਫੋਟੋਗ੍ਰਾਫਰੀ ਪੁਰਾਣੀ ਜਾਂ ਕਲਾਸਿਕ ਪੁਰਾਣੀ ਜਾਂ ਕਲਾਸਿਕ ਖੂਬਸੂਰਤੀ ਦਾ ਅਹਿਸਾਸ ਦਿੰਦੀ ਹੈ ਜਿਸ ਨਾਲ ਚਿੱਤਰਾਂ ਨੂੰ ਵਿਸ ਵਿਆਪਿਕ ਅਤੇ ਅਵ ਕੰਟ੍ਰੈਕਸ ਬਣਾਉਂਦੀ ਹੈ ਇਸ ਫੋਟੋਗ੍ਰਾਫਰੀ ਦਸਕਤ ਨੂੰ ਇੱਕ ਖ਼ਾਸ ਦ੍ਰਿਸ਼ਟੀ ਵਿੱਚ ਸੋਨ ਸੋਹਣਾ ਦਾ ਮੌਕਾ ਦਿੰਦੀ ਹੈ ਅਤੇ ਆਮ ਤੌਰ 'ਤੇ ਸਨਮਾਨ ਅਤੇ ਸਚਿਆਈ ਨੂੰ ਖੋਜਣ ਲਈ ਸਹਾਇਤਾ ਦਿੰਦੀ ਹੈ ਮੈਂ ਆਮ ਤੌਰ 'ਤੇ ਬਲੈਕ ਐਂਡ ਵਾਈਟ ਫ਼ੋਟੋ ਨੂੰ ਹੀ ਪਸੰਦ ਕਰਦਾ ਹਾਂ